ਯੋਗ ਅਪ ਇੱਕ ਕਿਰਿਆ ਹੈ ਜਿਸ ਨਾਲ ਬੰਦਾ ਫਿਟ ਰਹਿੰਦਾ ਹੈ ਅਤੇ ਮੈਂਟਲੀ ਅਤੇ ਫਿਜ਼ੀਕਲੀ ਅਤੇ ਸਟਰੋਂਗ ਹੁੰਦਾ ਹੈ ਯੋਗ ਦੇ ਵਿੱਚ ਮੇਰੀ ਬਹੁਤ ਰੁਚੀ ਹੈ ਯੋਗ ਦੇ ਵਿੱਚ ਸਭ ਤੋਂ ਪਸੰਦੀਦਾ ਆਸਣ ਮੇਰਾ ਸੂਰਿਆ ਨਮਸਕਾਰ ਹੈ ਸੂਰਿਆ ਨਮਸਕਾਰ ਸਵੇਰੇ ਸਵੇਰੇ ਉੱਠ ਕੇ ਪ੍ਰਾਤਾਕਾਲ ਕਰਨਾ ਚਾਹੀਦਾ ਹੈ ਹਰ ਬੰਦੇ ਨੂੰ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ ਬੰਦੇ ਦੀ ਊਰਜਾ ਨੂੰ ਬੜਾਵਾ ਮਿਲਦਾ ਹੈ ਸੂਰਿਆ ਨਮਸਕਾਰ ਇੱਕ ਐਸਾ ਆਸਣ ਹੈ ਜਿਸ ਨਾਲ ਜਿਸ ਨੂੰ ਕਰਨ ਦੇ ਨਾਲ ਬੰਦੇ ਨੂੰ ਦਿਮਾਗੀ ਤੌਰ 'ਤੇ ਫਿਜੀਕਲੀ ਤੌਰ 'ਤੇ ਆਪਣੀ ਫਿਟਨੈਸ ਬਰਕਰਾਰ ਰਹਿੰਦੀ ਹੈ ਸੂਰਿਆ ਨਮਸਕਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਲੱਤਾਂ ਬਾਹਾਂ ਗਰਦਨ ਪਿੱਠ ਸਾਰੀ ਹੀ ਐਕਟਿਵ ਪੁਜ਼ੀਸ਼ਨ 'ਚ ਆ ਜਾਂਦੀਆਂ ਹਨ ਜਿਸ ਦੇ ਨਾਲ ਸਾਰਾ ਦਿਨ ਤੁਹਾਨੂੰ ਸੁਸਤੀ ਨਹੀਂ ਪੈਂਦੀ ਸੂਰਿਆ ਨਮਸਕਾਰ ਦੇ ਵਿੱਚ ਜਿਸ ਤਰ੍ਹਾਂ ਕਿ ਮੈਨੂੰ ਡਿਸਕ ਦੀ ਪ੍ਰੋਬਲਮ ਹੈ ਉਹਦੇ ਵਿੱਚ ਸੂਰਿਆ ਨਮਸਕਾਰ ਨੂੰ ਠੀਕ ਕਰਨ ਦੇ ਲਈ ਸੂਰਿਆ ਨਮਸਕਾਰ ਸਭ ਤੋਂ ਵਧੀਆ ਆਸਨ ਹੈ ਇਸ ਦੇ ਵਿੱਚ ਤੰਦਰੁਸਤੀ ਚੁਸਤੀ ਫੁਰਤੀ ਸਭ ਤਰ੍ਹਾਂ ਦੇ ਬੰਦੇ ਦੀ ਫੀਚਰਸ ਇੰਦਰੀਆਂ ਕੰਟਰੋਲ 'ਚ ਆਉਂਦੀਆਂ ਹਨ ਅਤੇ ਠੀਕ ਹੁੰਦੀਆਂ ਹਨ ਸੂਰਿਆ ਨਮਸਕਾਰ ਦੇ ਨਾਲ ਆਦਮੀ ਦੀ ਮੈਡੀਟੇਸ਼ਨ ਕਿਰਿਆ ਲ ਔਰ ਫਿਜੀਕਲੀ ਫਿਟ ਲੱਤਾਂ ਬਾਹਾਂ ਖੁੱਲ੍ਹਦੀਆਂ ਹਨ ਅਤੇ ਪਿੱਠ ਦੀ ਜਕੜਨਾ ਖ਼ਤਮ ਹੁੰਦੀਆਂ ਹਨ ਸੂਰਿਆ ਨਮਸਕਾਰ ਕਰਨਾ ਸਾਡੇ ਸਿਹਤ ਦੇ ਲਈ ਸਭ ਤੋਂ ਵਧੀਆ ਆਸਨ ਹੈ ਸੂਰਿਆ ਨਮਸਕਾਰ ਦਿਨ ਦੇ ਵਿੱਚ ਚਾਰ ਤੋਂ ਪੰਜ ਵਾਰੀ ਸਾਨੂੰ ਸਵੇਰੇ ਸਵੇਰੇ ਉੱਠ ਕੇ ਕਰਨਾ ਚਾਹੀਦਾ ਹੈ ਖਾਲ੍ਹੀ ਪੇਟ ਦੀ ਕ੍ਰਿਆ ਹੈ ਜਿਹਦੇ ਨਾਲ ਬੰਦਾ ਬਹੁਤ ਤੰਦਰੁਸਤ ਅਤੇ ਦਰੁਸਤ ਰਹਿੰਦਾ ਹੈ